ਸਕੂਲਾਂ ਵਿੱਚ ਕਈ ਵਿਸ਼ੇ ਪੜ੍ਹਾਏ ਜਾਂਦੇ ਹਨ ਜਿਵੇਂ ਅੰਗਰੇਜ਼ੀ ਪੰਜਾਬੀ ਹਿਸਾਬ ਸਾਇੰਸ ਸਮਾਜਿਕ ਵਿਗਿਆਨ ਅਰਥ ਸ਼ਾਸਤਰ ਡਰਾਇੰਗ ਫਿਜ਼ੀਕਲ ਐਜੂਕੇਸ਼ਨ ਇਸ ਤਰ੍ਹਾਂ ਹੋਰ ਕਈ ਸਾਰੇ ਵਿਸ਼ੇ ਹਨ ਜਿਹੜੇ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਹਨ ਔਰ ਸਕੂਲਾਂ ਵਿੱਚ ਅਧਿਆਪਕ ਤਾਂ ਬਹੁਤ ਪੜ੍ਹੇ ਲਿਖੇ ਹਨ ਕਿਉਂਕਿ ਅੱਜ ਕੱਲ੍ਹ ਤਾਂ ਹੁਣ ਨਵੇਂ ਕਾਨੂੰਨ ਬਣ ਗਏ ਹਨ ਕਿ ਇੱਕ ਅਸੀਂ ਟੈਟ ਪਾਸ ਕਰਕੇ ਹੀ ਸਕੂਲ ਵਿੱਚ ਅਸੀਂ ਪੜ੍ਹਾ ਸਕਦੇ ਹਾਂ ਅਲੀਜੀਬਲ ਹੋਵਾਂਗੇ ਸਕੂਲ ਪੜ੍ਹਾਉਣ ਵਾਸਤੇ ਔਰ ਉਹ ਟੈਟ ਜਿਹੜਾ ਪਾਸ ਕਰਨਾ ਕੋਈ ਸੌਖਾ ਨਹੀਂ ਹੈ ਉਹਦੇ ਵਾਸਤੇ ਬਹੁਤ ਐਕਸਪੀਰੀਅੰਸ ਦੀ ਬਹੁਤ ਨੋਲੇਜ ਦੀ ਲੋੜ ਹੈ ਜਿਹਦੇ ਕਰਕੇ ਹੁਣ ਅੱਜ ਕੱਲ੍ਹ ਕੋਈ ਅਧਿਆਪਕ ਇਹੋ ਜਿਹਾ ਨਹੀਂ ਹੈ ਜੋ ਪੜ੍ਹਿਆ ਲਿਖਿਆ ਨਾ ਹੋਵੇ